ਹਾਂਜੀ ਮੈਂ ਬਹੁਤ ਸਾਰੀਆਂ ਫੋਟੋਆਂ ਬਲੈਕ ਐਂਡ ਵਾਈਟ ਫਿਲਟਰ ਲਗਾ ਕੇ ਖਿੱਚੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀਆਂ ਹਨ ਜਿਨ੍ਹਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਲਾਈਕ ਵੀ ਬਹੁਤ ਜ਼ਿਆਦਾ ਆਉਂਦੇ ਹਨ ਅਤੇ ਮੋਨੋਕਰੋਮੈਟਿਕ ਚਿੱਤਰਾਂ ਬਾਰੇ ਮੇਰੀ ਇਹੀ ਅਪੀਲ ਹੈ ਕਿ ਇਹ ਚਿੱਤਰਾਂ ਦੀ ਪੂਰਤੀ ਲਈ ਸਾਨੂੰ ਬਹੁਤ ਹੀ ਆਧੁਨਿਕ ਅਤੇ ਐੱਚ ਡੀ ਕੁਆਲਿਟੀ ਦੀ ਤਸਵੀਰ ਖਿੱਚਣੀ ਪੈਂਦੀ ਹੈ ਜਿਸ ਕਰਕੇ ਇਸ ਫੋਟੋ ਨੂੰ ਅਲੌਕਿਕ ਬਣਾਇਆ ਜਾ ਸਕਦਾ ਹੈ